ਹਾਂਜੀ ਗੂੰਜਨ ਕਿਆ ਹਾਲ ਹੈ ਬਸ ਠੀਕ ਮੈਂ ਅੱਜ ਈਵਿੰਗ ਬੈਠ ਕੇ ਬੁੱਕ ਰੀਡ ਕਰ ਰਹੀ ਸੀ ਗੂੰਜਨ ਮੈਨੰ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਬੂਕ ਬਾਰੇ ਥੋੜ੍ਹੀ ਡਿਸਕਸ਼ਨ ਕਰਨੀ ਚਾਹੀਦੀ ਹੈ ਕਿ ਆਪਾਂ ਦੋਵਾਂ ਨੂੰ ਥੋੜ੍ਹਾ ਇੰਟਰਸਟ ਚ ਹੈ ਨਾ ਜੋ ਰਿਸੈਂਟ ਇੱਕ ਹਾਂਜੀ ਕੋਵਿਡ 'ਤੇ ਇੱਕ ਬੁੱਕ ਆਈ ਹੈ ਨਾ ਅਤੇ ਉਹ ਤੁਹਾਨੂੰ ਕਿਵੇਂ ਲੱਗਿਆ

ਬਿਲਕੁਲ ਕੁਛ ਇੱਦਾਂ ਲੱਗਿਆ ਕਿ ਕੁਛ ਕੁਛ ਚੀਜ਼ਾਂ ਉਹਨਾਂ ਨੇ ਸਕਿਪ ਕਰ ਦਿੱਤੀਆਂ ਹੈ ਨਾ ਅਤੇ ਲਾਈਕ ਲੋਕ ਦੇ

ਕਾਫੀ ਕੁਝ ਸਕਿਪ ਹੋਇਆ ਹਾਂਜੀ ਕਿਉਂਕਿ ਉਸ ਦੌਰਾਨ ਲੋਕਾਂ ਦੀ ਮੈਂਟਲ ਹੈਲਥ ਬਹੁਤ ਜਿਆਦਾ ਇਫੈਕਟ ਹੋਈ ਹੈ ਹੈ ਨਾ ਫਿਜੀਕਲੀ ਤਾਂ ਚਲੋ ਜੋ ਵੀ ਇਕ ਲੋਸ ਹੋਇਆ ਫਿਜੀਕ ਮਤਲਬ ਦੇਖੋ ਲੋਕਾਂ ਦੀ ਲਾਈਫ ਦਾ ਲੋਸ ਹੈ ਬਹੁਤ ਸਾਰੇ ਲੋਕ ਡੂਰਿੰਗ ਦੈਟ ਪੀਰੀਅਡ ਹਮ ਹੈ ਨਾ ਆਪਾਂ ਨੂੰ ਵੀ ਪਤਾ ਹੈ ਬਟ ਜੋ ਉਹਨਾਂ ਦਾ ਮੈਂਟਲ ਲੈਵਲ ਜਿੱਥੇ ਗਿਆ ਓਸ ਚੀਜ਼ਾਂ ਨੂੰ ਉਹਨਾਂ ਨੇ ਬੜਾ ਸਕਿਪ ਕਰ ਮਤਲਬ ਕਾਫੀ ਕੁਝ ਉਹਨਾਂ ਨੇ ਸਕਿਪ ਕਰ ਦਿੱਤਾ ਹੋਇਆ ਉਸ ਰਾਈਟਰ ਨੇ ਨਾ ਔਰ ਹਾਂ ਬਿਲਕੁਲ ਹਾਂ ਉਸ ਚੀਜ਼ਾਂ ਨਾ ਬਹੁਤ ਲੱਗਿਆ ਮੈਨੂੰ ਕਿ ਹਾਂ ਇਸ ਟਾਈਟਲ ਹੈ ਨਾ ਬਹੁਤ ਚੀਜ਼ਾਂ ਸਕਿਪ ਕਰ ਦਿੱਤੀਆਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਸ ਟਾਈਮ ਦੇ ਦੌਰਾਨ ਫੇਸ ਕੀ ਕੀਤਾ ਲੋਕਾਂ ਨੇ ਹੈ ਨਾ ਮਤਲਬ ਆਪਣੀ ਜਨਰੇਸ਼ਨ ਨੈਕਸਟ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਜੋ ਰੀਡ ਕਰਨ ਬੁੱਕ

ਚਲੋ ਹਰ ਇੱਕ ਦਾ ਨਾ ਆਪਣਾ ਪੁਆਇੰਟ ਹੈ ਨਾ ਚਲੋ ਠੀਕ ਹੈ ਗੂੰਜਨ ਓਕੇ